ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਰੁਣ ਕੁਮਾਰ ਹੈ ਮੈ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਹਿੰਦਾ ਹਾਂ ਅੱਜ ਜੇ ਮੈਨੂੰ ਪੁੱਛਿਆ ਜਾਵੇ ਕਿ ਬਾਈਕਿੰਗ ਕਮਿਊਨਿਟੀ ਵਿੱਚ ਸ਼ਾਮਿਲ ਹੋਣ ਅਤੇ ਹੋਰ ਸਵਾਰੀਆਂ ਨੂੰ ਮਿਲਣ ਦੇ ਕੁਝ ਵਧੀਆ ਤਰੀਕੇ ਕੀ ਹਨ ਜਾਂ ਕੀ ਤੁਸੀਂ ਇਕੱਲੇ ਬਾਈਕਿੰਗ ਤਰਜੀਹ ਦਿੰਦੇ ਹੋ ਅਤੇ ਕਿਉਂ ਇਸ ਦੇ ਉੱਤੇ ਵਿੱਚ ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਬਾਈਕਿੰਗ ਕਮਿਊਨਿਟੀ ਵਿੱਚ ਸ਼ਾਮਿਲ ਹੋਣ 'ਤੇ ਹੋਰ ਸਵਾਰੀਆਂ ਨੂੰ ਮਿਲਣ ਦੇ ਬਹੁਤ ਸਾਰੇ ਵਧੀਆ ਤਰੀਕੇ ਹਨ ਇਹ ਸਾਡੀ ਆਪਣੀ ਬਾਈਕਿੰਗ ਦੇ ਅਨੁਭਵ ਨੂੰ ਕੇਵਲ ਸੁਧਾਰ ਸਕਦੇ ਹਨ ਅਤੇ ਸਗੋਂ ਸਾਨੂੰ ਨਵੇਂ ਦੋਸਤਾਂ ਦੇ ਸਮਰਥਨ ਵੀ ਪ੍ਰਾਪਤ ਕਰਦੇ ਹਨ ਬਾਈਕਿੰਗ ਕਮਿਊਨੀ ਵਿੱਚ ਸ਼ਾਮਿਲ ਹੋਣ ਦੇ ਨਾ ਬਹੁਤ ਸਾਰੇ ਤਰੀਕੇ ਹਨ ਜਿਵੇਂ ਕਿ ਬਾਈਕਿੰਗ ਕਲੱਬ ਜਿਹੜੇ ਸਮੂਹ ਹੁੰਦੇ ਆ ਗਰੁੱਪ ਹੁੰਦੇ ਆ ਉਹਨਾਂ ਵਿੱਚ ਜਾ ਕੇ ਇਹਨਾਂ ਵਿੱਚ ਕੀ ਹੁੰਦਾ ਹੈ ਆਪਣੇ ਜਿਹੜੇ ਮੁਹੱਲੇ ਬਾਈਕਿੰਗ ਕਲੱਬ ਹੁੰਦੇ ਆ ਉਹਨਾਂ ਥਾਣੇ ਆਪਾਂ ਕਰ ਸਕਦੇ ਹਾਂ ਸਾਡੇ ਆਪਣੇ ਸ਼ਹਿਰਾਂ ਜਾਂ ਕਸਬਿਆਂ ਵਿੱਚ ਸ਼ਹਿਰਾਂ ਜਾਂ ਕਸਬਿਆਂ ਵਿੱਚ ਮੁਹੱਲੇ ਕਲੱਬ ਮੈਂਬਰ ਬਣਨਾ ਚਾਹੀਦਾ ਸਾਨੂੰ ਇਹਨਾਂ ਕਲੱਬਾਂ ਵਿੱਚ ਅਕਸਰ ਛੋਟੀਆਂ ਮੋਟੀਆਂ ਰਾਈਡਾਂ ਹੁੰਦੀਆਂ ਰਹਿੰਦੀਆਂ ਹਨ ਜਿਸ ਦੇ ਨਾਲ ਆਪਾਂ ਮੈਂਬਰ ਬਣ ਸਕਦੇ ਹਾਂ ਦੂਜੀ ਗੱਲ ਕਰੀਏ ਤਾਂ ਆਪਾਂ ਸੋਸ਼ਲ ਮੀਡੀਆ ਥਾਣੀ ਹੋ ਸਕਦੇ ਹਾਂ ਜਿਵੇਂ ਕਿ ਫੇਸਬੁੱਕ ਇੰਸਟਾਗ੍ਰਾਮ ਇਹਨਾਂ ਵਰਗੇ ਜਿਹੜੇ ਮੀਟ ਅਪ ਵਰਗੇ ਪਲੈਟਫੋਮ ਹੁੰਦੇ ਹਨ ਇਹਨਾਂ 'ਤੇ ਬਾਈਕਿੰਗ ਸਮੂਹ ਵਾਲੇ ਬਹੁਤ ਸਾਰੇ ਚੈਨਲ ਹੁੰਦੇ ਜਿਹਨਾਂ ਰਾਹੀਂ ਆਪਾਂ ਸ਼ਾਮਿਲ ਹੋ ਸਕਦੇ ਹਨ ਤੀਜਾ ਹੁੰਦਾ ਹੈ ਕਿ ਬਾਈਕਿੰਗ ਰਾਈਡਾਂ 'ਚ ਜਿਹਦੇ ਵਿੱਚ ਕਿ ਰਾਈਡਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ ਇਹ ਜਿਹੜੀ ਬਾਈਕਿੰਗ ਰਾਈਡਾਂ ਹੁੰਦੀਆਂ ਨੇ ਇਹਨਾਂ ਵਿੱਚ ਸਾਨੂੰ ਭਾਗ ਲੈਣਾ ਚਾਹੀਦਾ ਹੈ ਇਹ ਰਾਈਡਾਂ ਅਕਸਰ ਚੈਰਿਟੀ ਜਾਂ ਸ਼ੌਕ ਦੇ ਲਈ ਆਯੋਜਿਤ ਕੀਤੀਆ ਜਾਂਦੀਆ ਹਨ ਦੂਜਾ ਸਮੂਹ ਰਾਈਡਿੰਗ ਹੁੰਦੀ ਹੈ ਇਹ ਹਫਤਾਵਾਰੀ ਜਾਂ ਫਿਰ ਮਹੀਨਾਵਾਰੀ ਸਮੂਹ ਰਾਈਡਾਂ ਕੀਤੀਆਂ ਜਾਂਦੀਆਂ ਹਨ ਜਿਹਨਾਂ ਦਾ ਅਯੋਜਨ ਜਿਹਨਾਂ ਦਾ ਜਿਹੜਾ ਅਯੋਜਨ ਹੁੰਦਾ ਨਾ ਇਹ ਬਾਈਕਰ ਆਪੇ ਕਰ ਲੈਂਦੇ ਹਨ ਸਾਨੂੰ ਵੱਖ ਵੱਖ ਵਰਕਸ਼ਾਪਾਂ ਅਤੇ ਸੈਮੀਨਾਰਾਂ ਵਿੱਚ ਵੀ ਜਾਣਾ ਚਾਹੀਦਾ ਹੈ ਸਿਖਲਾਈ ਵਰਕਸ਼ਾਪ ਜਿਹੜੇ ਹੁੰਦੇ ਜਿੱਥੇ ਕਿ ਬਾਈਕਾਂ ਦੀ ਮੁਰੰਮਤ ਸੁਰੱਖਿਆ ਜਾਂ ਦੂਜੀਆਂ ਸਿੱਖਣ ਵਾਲੀਆਂ ਵਰਕਸ਼ੋਪਾਂ ਵਿੱਚ ਭਾਗ ਲੈਣਾ ਚਾਹੀਦਾ ਸਾਨੂੰ ਬਾਈਕ ਦੀਆਂ ਜਿਹੜੀਆਂ ਰੇਸਾਂ ਹੁੰਦੀਆਂ ਨੇ ਉਹਨਾਂ ਵਿੱਚ ਵੀ ਸਾਨੂੰ ਭਾਗ ਲੈਣਾ ਚਾਹੀਦਾ ਹੈ ਇਹਦੇ ਨਾਲ ਆਪਾਂ ਆਪਣੇ ਹੁਨਰ ਨੂੰ ਵੀ ਨਿਖਾਰ ਸਕਦੇ ਹਾਂ ਜਾਂ ਹੋਰ ਸਵਾਰੀਆਂ ਨੂੰ ਮਿਲ ਸਕਦੇ ਹਾਂ ਸਾਨੂੰ ਮੌਕੇ ਮਿਲਦੇ ਹਨ ਅਤੇ ਹੁਣ ਜੇ ਗੱਲ ਕਰੀਏ ਕਿ ਇਕੱਲੇ ਬਾਈਕਿੰਗ ਕਰਨ ਦੇ ਕੀ ਕੀ ਫਾਇਦੇ ਹਨ ਇਸਦੇ ਵਿੱਚ ਆ ਜਾਂਦਾ ਹੈ ਕਿ ਲਚੀਲਾਪਨ ਹੋ ਜਾਂਦਾ ਬੰਦੇ ਨੂੰ ਜਿਹਦੇ 'ਚ ਆਪਾਂ ਕੀ ਹੁੰਦਾ ਆਪਣੇ ਸਮੇਂ 'ਤੇ ਆਰਾਮ ਨਾਲ ਪੁੱਛ ਸਕਦੇ ਹਾਂ ਆਪਣੀ ਸੁਵਿਧਾ ਅਨੁਸਾਰ ਕਿਤੇ ਵੀ ਬਾਈਕਿੰਗ ਕਰ ਸਕਦੇ ਆਰਾਮ ਨਾਲ ਇਹਦੇ ਨਾਲ ਆਪਾਂ ਆਪਣੀ ਪਸੰਦ ਦੀ ਗਤੀ ਦੇ ਨਾਲ ਗੱਡੀ ਚਲਾ ਸਕਦੇ ਹਾਂ ਆਪਣੀ ਰਫਤਾਰ ਨਾਲ ਆਪਾਂ ਆਪੇ ਚੱਲ ਸਕਦੇ ਹਾਂ ਅਤੇ ਅਤੇ ਸੰਤੁਲਨ ਬਣਾਉਣਾ ਆਪਣਾ ਬਹੁਤ ਜ਼ਰੂਰੀ ਹੋ ਜਾਂਦਾ ਨਾਲ ਸਾਨੂੰ ਨਾਲੇ ਇਹਦੇ ਨਾਲ ਸਾਨੂੰ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ ਅਤੇ ਆਪਾਂ ਇਕੱਲੇ ਬਾਈਕਿੰਗ ਸਾਨੂੰ ਸਾਡੇ ਵਿਚਾਰਾਂ ਨੂੰ ਕੇਂਦਰਿਤ ਕਰਨ ਵਿੱਚ ਮੌਕਾ ਦਿੰਦੀ ਹੈ ਇਸ ਨਾਲ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਇਕੱਲੇ ਬਾਈਕਿੰਗ ਕਰਨ ਨਾਲ ਕੁਦਰਤ ਵਿੱਚ ਰਾਈਡ ਦਾ ਆਨੰਦ ਮਾਣ ਸਕਦੇ ਹਾਂ ਆਪਾਂ ਇਹਦੇ ਨਾਲ ਇਸਦੇ ਨਾਲ ਸਾਨੂੰ ਆਤਮ ਨਿਰਭਰਤਾ ਮਿਲਦੀ ਹੈ ਇਕੱਲੇ ਬਾਈਕਿੰਗ ਕਰਨ ਨਾਲ ਕੀ ਹੁੰਦਾ ਕਿ ਸਾਨੂੰ ਆਤਮ ਨਿਰਭਰ ਹੋ ਸਕਦੇ ਹਾਂ ਆਪਾਂ ਅਤੇ ਬਾਈਕਿੰਗ ਦਾ ਚੈੱਕ ਅਪ ਕਰਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਇਹਦੇ ਨਾਲ ਇਹਦੇ ਨਾਲ ਕੀ ਆ ਆਪਾਂ ਹੋ ਜਾਂਦਾ ਕਿ ਆਪਾਂ ਆਪਣੀ ਪਸੰਦ ਦਾ ਜੇ ਕੋਈ ਵੀ ਰਸਤਾ ਖੋਜਣਾ ਹੋਏ ਨਾ ਆਪਾਂ ਇਕੱਲੇ ਖੋਜ ਸਕਦੇ ਹਾਂ ਇਕੱਲੇ ਬਾਈਕਿੰਗ ਕਰਨ ਨਾਲ ਅਤੇ ਇਕੱਲੇ ਬਾਈਕਿੰਗ ਕਰਨ ਵਿੱਚ ਮੁਸ਼ਕਿਲਾਂ ਕਿਹੜੀਆ ਹੁੰਦੀਆ ਉਹਦੀ ਗੱਲ ਕਰੀਏ ਤਾਂ ਕਿਉਂਕਿ ਸਰੱਖਿਆ ਆ ਜਾਂਦੀ ਹੈ ਕਿ ਇਕੱਲੇ ਬਾਈਕਿਗ ਕਰਨ ਵਿੱਚ ਨਾ ਸੁਰੱਖਿਆ ਦੇ ਮਾਮਲੇ ਬਹੁਤ ਵੱਧ ਜਾਂਦੇ ਹਨ ਇਹਦੇ ਵਿੱਚ ਸਾਨੂੰ ਮੋਟੀਵੇਸ਼ਨ ਦੀ ਵੀ ਬਹੁਤ ਸਾਰੀ ਕਮੀ ਹੋ ਜਾਂਦੀ ਹੈਗੀ ਸਮੂਹ ਵਿੱਚ ਬਾਈਕਿੰਗ ਕਰਨ ਨਾਲ ਨਾ ਸਾਨੂੰ ਮੋਟੀਵੇਸ਼ਨ ਜ਼ਿਆਦਾ ਰਹਿੰਦਾ ਹੈ ਤੀਜਾ ਫਿਰ ਆਪਾਂ ਜੇ ਫੈਸਲੇ ਦੀ ਗੱਲ ਕਰੀਏ ਕਿ ਕਮਿਊਨਿਟੀ ਵਿੱਚ ਬਾਈਕਿੰਗ ਕਰਨੀ ਚਾਹੀਦੀ ਹੈ ਇਕੱਲੇ ਇਸ ਵਿੱਚ ਬਸ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਇਹ ਪੂਰੀ ਤਰ੍ਹਾਂ ਸਾਡੀ ਆਪਣੀ ਪਸੰਦ ਹੈ ਕਿ ਆਪਾਂ ਕਮਿਊਨਿਟੀ ਵਿੱਚ ਸ਼ਾਮਿਲ ਹੋਣ ਨਾਲ ਸਾਨੂੰ ਕੀ ਹੁੰਦਾ ਸਮਾਜਿਕ ਸਹਿਯੋਗ ਅਤੇ ਸਿਖਲਾਈ ਮਿਲ ਜਾਂਦੀ ਹੈ ਇਕੱਲੇ ਬਾਈਕਿੰਗ ਕਰਨ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਤਾਂ ਆਤਮ ਨਿਰਭਰ ਹੋ ਜਾਂਦੇ ਹਾਂ ਆਪਾਂ ਥੋੜ੍ਹੇ ਜਿਹੇ ਦੋਵਾਂ ਵਿੱਚ ਆਪਾਂ ਕੁਝ ਵੀ ਸੁਣ ਸਕਦੇ ਚੁਣ ਸਕਦੇ ਹਾਂ ਜਾਂ ਫਿਰ ਇਹਨਾਂ ਵਿੱਚ ਨਾ ਸੰਤੁਲਨ ਬਣਾ ਕੇ ਰਹਿ ਸਕਦੇ ਹਾਂ ਅਤੇ ਜੇ ਆਪਾਂ ਆਪਣੀ ਗੱਲ ਕਰੀਏ ਮੈਂ ਕੀ ਮੈਂ ਕੀ ਕਰਨਾ ਚਾਹੁੰਦਾ ਵਾ ਇਹ ਜ਼ਰੂਰੀ ਹੈ ਕਿ ਅਸੀਂ ਨਾ ਸਭ ਤੋਂ ਵਧੀਆ ਤਰੀਕੇ ਦੀ ਪਛਾਣ ਕਰੀਏ ਆਪੇ ਅਸੀਂ ਕਮਿਊਨਿਟੀ ਦੀ ਸਹਾਇਤਾ ਚਾਹੁੰਦੇ ਹਾਂ ਅਤੇ ਅਤੇ ਇਕੱਲੇ ਬਾਈਕਿੰਗ ਮੌਜ ਲੈਣਾ ਚਾਹੁੰਦੇ ਹਾਂ ਮੈਂ ਤਾਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਧੰਨਵਾਦ